ਜੀ ਹਾਂ ਮੈਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜਿਸ ਨੂੰ ਮੈ ਜਿਸ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਸ ਜ਼ਮਾਨ ਕਿ ਪਿਛਲੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਸਨ ਅਤੇ ਇਹ ਕਿਤਾਬ ਮੈਂ ਹਿਸਟਰੀ ਦੀ ਪੜ੍ਹੀ ਸੀ ਜਿਸਦੇ ਵਿੱਚ ਮੈਂ ਇਹ ਕੰਨਸੈਪਟ ਪੜ੍ਹਿਆ ਸੀ ਕੀ ਸੀ ਕੀ ਕਿ ਜਦੋਂ ਪਤੀ ਦੀ ਮੌਤ ਹੁੰਦੀ ਸੀ ਤਾਂ ਉਸਦੀ ਪਤਨੀ ਨੂੰ ਵੀ ਜਿੰਦਾ ਹੀ ਉਸਦੀ ਚਿਖਾ ਦੇ ਨਾਲ ਛਡਾਇਆ ਸੜਾਇਆ ਜਾਂਦਾ ਸੀ ਅਤੇ ਇਹ ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਉਸਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇੱਦਾਂ ਦੀ ਅਜੀਬ ਗੱਲ ਵੀ ਉਸ ਸ ਉਸ ਸਮੇਂ ਵਿੱਚ ਹੁੰਦੀ ਸੀ ਭਾਵੇਂ ਕਿ ਇਹ ਗੱਲ ਹੁਣ ਨਹੀਂ ਇਹ ਗੱਲ ਜਾਂ ਘਟਨਾ ਹੁਣ ਨਹੀਂ ਕੀਤੀ ਜਾਂਦੀ ਪਰ ਉਸ ਉਸ ਸਮੇਂ ਦੀ ਇਹ ਗੱਲ ਸੱਚੀ ਜੇਕਰ ਇਹ ਗੱਲ ਸੱਚੀ ਹੈ ਤਾਂ ਬਹੁਤ ਹੀ ਦੁੱਖ ਭਰੀ ਹੈ ਕਿਉਂਕਿ ਕਿਉਂਕਿ ਇਹ ਕਿਉਂਕਿ ਇਹ ਇੱਕ ਬਹੁਤ ਹੀ ਅਜੀਬ ਘਟਨਾ ਅਜੀਬ ਘਟਨਾ ਹੈ ਕਿ ਜਿਉਂਦਿਆਂ ਨੂੰ ਹੀ ਸਾੜ ਦੇਣਾ